ਨੌਕਰੀ ਪੜ੍ਹਾਈ ਸਿੱਖਿਆ ਪੱਧਰ ਕੀ ਹੈ ਜਦੋਂ ਤੱਕ ਸਾਨੂੰ ਆਪਣੇ ਆਪ ਦਾ ਗਿਆਨ ਨਹੀਂ ਹੈ ਆਪਣੇ ਪਰਿਵਾਰ ਸੱਭਿਆਚਾਰ ਇਹਦਾ ਗਿਆਨ ਨਹੀਂ ਹੈ ਪੜ੍ਹਾਈ ਕੁਛ ਵੀ ਨਹੀਂ ਹੈ ਜਿੰਨਾ ਮਰਜ਼ੀ ਪੜ੍ਹ ਲਉ ਜਿੰਨੀਆਂ ਮਰਜ਼ੀਆਂ ਡਿਗਰੀਆਂ ਲੈ ਲਉ ਜਦੋਂ ਤੱਕ ਅਸੀਂ ਆਪਣੇ ਬਜ਼ੁਰਗਾਂ ਦੀ ਮਾਂ ਬਾਪ ਆਪਣੇ ਵੱਡੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ ਪੜ੍ਹਾਈ ਬਿਲਕੁਲ ਖ਼ਤਮ ਹੈ ਇਹੀ ਜਿਹੜੀ ਹੈ ਮੇਰੀ ਪੜ੍ਹਾਈ ਹੈ